ਬਾਗਬਾਨੀ ਵਿਹੜੇ ਵਿੱਚ ਵੀ ਕੀਤੀ ਜਾਂਦੀ ਹੈ ਅਤੇ ਬਾਗਬਾਨੀ ਛੱਤ ਉੱਪਰ ਵੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਇਹਦੇ ਵਿੱਚ ਜ਼ਿਆਦਾ ਹੁੰਦੀ ਕਿ ਜਿਸ ਤਰ੍ਹਾਂ ਸਾਡੇ ਕੋਲ ਜਗ੍ਹਾ ਨਾ ਹੋਵੇ ਜ਼ਿਆਦਾ ਥਾਂ ਨਾ ਹੋਵੇ ਅਤੇ ਅਸੀਂ ਉਹਨੂੰ ਛੱਤ ਉੱਤੇ ਬਾਗਬਾਨੀ ਕਰਦੇ ਹਾਂ ਪਰ ਅਸੀਂ ਇੱਕ ਪੇਂਡੂ ਇਲਾਕੇ ਵਿੱਚ ਰਹਿਣ ਕਰਕੇ ਪਿੰਡ ਵਿੱਚ ਰਹਿਣ ਕਰਕੇ ਸਾਡੇ ਕੋਲ ਜਗ੍ਹਾ ਜ਼ਿਆਦਾ ਹੋਣ ਕਰਕੇ ਅਸੀਂ ਜ਼ਿਆਦਾਤਰ ਜਿਹੜੀ ਬਾਗਬਾਨੀ ਆ ਵਿਹੜੇ ਵਿੱਚ ਕਰਦੇ ਹਾਂ ਫਿਰ ਬਾਗਬਾਨੀ ਦੇ ਵਿੱਚ ਅਸੀਂ ਜਿਸ ਤਰ੍ਹਾਂ ਫਲਾਂ ਵਾਲੇ ਬੂਟੇ ਲਾਉਂਦੇ ਹਾਂ ਸਬਜ਼ੀਆਂ ਲਾਉਂਦੇ ਹਾਂ ਸ ਸਬਜ਼ੀਆਂ ਦੀ ਕਾਸ਼ਤ ਕਰਦੇ ਹਾਂ ਫਿਰ ਉਹਦੇ ਵਿੱਚ ਹੀ ਸਾਨੂੰ ਜਿਸ ਤਰ੍ਹਾਂ ਨਿੰਮ ਵਰਗੇ ਕੌੜ ਤਰੇਗ ਹੋਈ ਇਹੋ ਜਿਹੇ ਇੱਕ ਕੀਟਨਾਸ਼ਕ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਇਹਦੇ ਨਾਲ਼ ਕੀਟਨਾਸ਼ਕ ਸਾਡੀ ਜਿਹੜੀ ਮਤਲਬ ਮਿੱਟੀ ਹੋ ਜਾਂਦੀ ਹੈ ਜਦੋਂ ਇਹਨਾਂ ਦੇ ਪੱਤੇ ਡਿੱਗਦੇ ਹਨ ਅਤੇ ਉਹਦੇ ਨਾਲ਼ ਸਾਨੂੰ ਜਿਸ ਤਰ੍ਹਾਂ ਸਪ੍ਰੇਹਾਂ ਜ਼ਿਆਦਾ ਮਹਿੰਗੀਆਂ ਨਹੀਂ ਕਰਨੀਆਂ ਪੈਂਦੀਆਂ ਅਤੇ ਫਲਦਾਰ ਬੂਟੇ ਲਾਏ ਜਾਂਦੇ ਹਨ ਜਿਸ ਤਰ੍ਹਾਂ ਅਸੀਂ ਹਾੜੀ ਸਾਉਣੀ ਆਪਣੇ ਇਹ ਬਿਲਕੁਲ ਔਰਗੈਨਿਕ ਜਿਸ ਤਰ੍ਹਾਂ ਲਾ ਲਓ ਖੇਤੀ ਹੋ ਗਈ ਬਿਨਾਂ ਦਵਾਈਆਂ ਤੋਂ ਹੀ ਫ਼ਲ ਬੂਟੇ ਆਪਣੇ ਵਰਤਦੇ ਹਾਂ